ਯੋਗਾ ਦੇ ਬਹੁਤ ਸਾਰੇ ਇੱਦਾਂ ਦੇ ਰੂਪ ਹਨ ਜੋ ਕਿ ਸਾਨੂੰ ਸ਼ੁਰੂ ਸ਼ੁਰੂ ਵਿੱਚ ਬਹੁਤ ਹੀ ਜ਼ਿਆਦਾ ਚੁਣੌਤੀਪੂਰਨ ਲੱਗਦੇ ਹਨ ਕਿਉਂਕਿ ਯੋਗਾ ਇੱਕ ਐਸੀ ਚੀਜ਼ ਹੈ ਜੋ ਕਿ ਦੇਖਣ ਵਿੱਚ ਆਸਾਨ ਲੇਕਿਨ ਕਰਨ ਵਿੱਚ ਥੋੜ੍ਹੀ ਔਖੀ ਹੁੰਦੀ ਹੈ ਯੋਗਾ ਜਦੋਂ ਮੈਂ ਸ਼ੁਰੂ ਸ਼ੁਰੂ ਵਿੱਚ ਕਰਨਾ ਸਿੱਖਿਆ ਸੀ ਉਦੋਂ ਮੈਨੂੰ ਬਹੁਤ ਹੀ ਜ਼ਿਆਦਾ ਚੁਣੌਤੀਪੂਰਨ ਲੱਗਦਾ ਸੀ ਕਿਉਂਕਿ ਜਦੋਂ ਅਸੀਂ ਨਵਾਂ ਨਵਾਂ ਯੋਗਾ ਕਰਦੇ ਹਾਂ ਤਾਂ ਸਾਨੂੰ ਵੱਖ ਵੱਖ ਤਰ੍ਹਾਂ ਦੇ ਪੋਜ ਬਣਾਉਣੇ ਪੈਂਦੇ ਹਨ ਅਤੇ ਉਹ ਇਸ ਪ੍ਰਕਾਰ ਹੁੰਦੇ ਹਨ ਕਿ ਜੇਕਰ ਅਸਾਹੀ ਅਸੀਂ ਗਲਤ ਪੋਜ ਕਰੀਏ ਤਾਂ ਉਹ ਸਾਡੇ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਕੁਛ ਵੀ ਹੋ ਸਕਦਾ ਹੈ ਇਸ ਕਰਕੇ ਸਾਨੂੰ ਪੂਰੀ ਸਹੀ ਸਲਾਮਤੀ ਨਾਲ ਯੋਗਾ ਦਾ ਪੋਜ ਬਿਲਕੁਲ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਾਡੇ ਸਰੀਰ ਉੱਤੇ ਅੱਛਾ ਅਸਰ ਪਾਏ ਜੇਕਰ ਮੈਂ ਗੱਲ ਕਰਾਂ ਯੋਗਾ ਦੇ ਸਾਡੇ ਜੀਵਨ ਵਿੱਚ ਕਿਹੜੇ ਫਾਇਦੇ ਹਨ ਤਾਂ ਸਾਡੇ ਸਾਨੂੰ ਯੋਗਾ ਕਰਨ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਸਭ ਤੋਂ ਵੱਡਾ ਫਾਇਦਾ ਹੈ ਕਿ ਯੋਗਾ ਸਾਨੂੰ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਤੰਦਰੁਸਤ ਰੱਖਦਾ ਹੈ ਯੋਗਾ ਕਰਨ ਨਾਲ ਸਾਨੂੰ ਕੋਈ ਵੀ ਤਰ੍ਹਾਂ ਦੀ ਗੈਸ ਬੀਪੀ ਜਾਂ ਸ਼ੁਗਰ ਦੀ ਬਿਮਾਰੀ ਨਹੀਂ ਹੁੰਦੀ ਕਿਉਂਕਿ ਮੈਨੂੰ ਮੈਂ ਅਸੀਂ ਪੂਰਾ ਪਰਿਵਾਰ ਯੋਗਾ ਕਰਦੇ ਹਾਂ ਅਤੇ ਪਹਿਲੇ ਨਾਲੋਂ ਕਾਫੀ ਤੰਦਰੁਸਤ ਹਾਂ ਯੋਗਾ ਨਾਲ ਸਾਨੂੰ ਫਾਲਤੂ ਦੀ ਟੈਨਸ਼ਨ ਨਹੀਂ ਰਹਿੰਦੀ ਅਤੇ ਸਾਡਾ ਦਿਮਾਗ ਅੱਛੀ ਜਗ੍ਹਾ ਚੱਲਦਾ ਹੈ ਧੰਨਵਾਦ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਯੋਗਾ ਕਰਨਾ ਚਾਹੀਦਾ ਹੈ